ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦਾਸਪੁਰ ਤੋਂ ਸੰਤੋਸ਼ ਕੁਮਾਰੀ ਬੋਲਦੀ ਪਈ ਹਾਂ ਮੈਂ ਤੁਹਾਨੂੰ ਹਾਂਜੀ ਦੱਸਣਾ ਚਾਹਵਾਂਗੀ ਕਿ ਸਾਡੇ ਇਲਾਕੇ ਵਿੱਚ ਜਿਹੜੇ ਵੈਟਰਨਰੀ ਡਾਕਟਰ ਆ ਡੰਗਰ ਡਾਕਟਰ ਆ ਉਪਲਬਧ ਹੈਗੇ ਹਨ ਅਤੇ ਅਸੀਂ ਮਤਲਬ ਕਿ ਆਪਣੇ ਜਾਨਵਰਾਂ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਉਹਨਾਂ ਦੀ ਉਹਨਾਂ ਨੂੰ ਘਰ ਬੁਲਾ ਕੇ ਜਾਨਵਰਾਂ ਬਾਰੇ ਪੁੱਛਣਾ ਪੈਂਦਾ ਹੈ ਕਿ ਇਹ ਠੀਕ ਆ ਇਹਨਾਂ ਦੀ ਸਿਹਤ ਠੀਕ ਆ ਇਹਨਾਂ ਦੀ ਤੰਦਰੁਸਤੀ ਲਈ ਸਾਨੂੰ ਕੀ ਕੀ ਇਹਨਾਂ ਨੂੰ ਚਾਰਾ ਪਾਉਣਾ ਚਾਹੀਦਾ ਖੁਰਾਕ ਦੇਣੀ ਚਾਹੀਦੀ ਹੈ ਫੀਡ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਸਿਹਤ ਵਧੀਆ ਰਹਿ ਸਕੇ ਅਤੇ ਇਸ ਲਈ ਸਾਨੂੰ ਜਾਨਵਰਾਂ ਦੀ ਸਿਹਤ ਅਤੇ ਕਾਫੀ ਪੈਸਾ ਖਰਚਣਾ ਪੈਂਦਾ ਹੈ ਤਾਂ ਕਿ ਅਸੀਂ ਇਹਨਾਂ ਨੂੰ ਤੰਦਰੁਸਤ ਰੱਖ ਸਕੀਏ ਠੀਕ ਆ ਤੰਦਰੁਸਤ ਰੱਖਣ ਦੇ ਨਾਲ ਫਿਰ ਅਸੀਂ ਇਹਨਾਂ ਨੂੰ ਮਤਲਬ ਵਧੀਆ ਤਰੀਕੇ ਨਾਲ ਆਪਾਂ ਉਹਨਾਂ ਨੂੰ ਚਾਰਾ ਵਗੈਰਾ ਦੇ ਅਤੇ ਕੋਈ ਬਿਮਾਰ ਹੋਏ ਫਿਰ ਉਹਨਾਂ ਨੂੰ ਦਵਾਈ ਦਵੁਈ ਦੇ ਸਕਦੇ ਹਾਂ ਇਸ ਲਈ ਸਾਨੂੰ ਵੈਟਰਨਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਕੰਮ ਵਿੱਚ ਤਾਂ ਕਿ ਉਹ ਸਾਨੂੰ ਆਪਣੇ ਜਾਨਵਰਾਂ ਨੂੰ ਸਿਹਤਮੰਦ ਰੱਖਣ ਲਈ ਕੀ ਦੱਸ ਸਕਦੇ ਹਨ ਕਿ ਇਹਨਾਂ ਨੂੰ ਇਹ ਦਵਾਈਆਂ ਦੀ ਲੋੜ ਆ ਅਤੇ ਤੁਸੀਂ ਇਹ ਦਵਾਈਆਂ ਉਹਨਾਂ ਨੂੰ ਪਾ ਸਕਦੇ ਹੋ ਠੀਕ ਆ ਇਹ ਸਾਨੂੰ ਵਧੀਆ ਤੋਂ ਵਧੀਆ ਦਵਾਈਆਂ ਜਿਹੜੀਆਂ ਪ੍ਰੋਵਾਈਡ ਕਰਵਾਉਂਦੀਆਂ ਹਨ ਤਾਂ ਕਿ ਸਾਡੇ ਇਹ ਜਾਨਵਰ ਜਿਹੜੇ ਉਹ ਠੀਕ ਰਹਿ ਸਕਣ ਉਹਨਾਂ ਦੀ ਸਿਹਤ ਠੀਕ ਰਹਿ ਸਕੇ ਅਤੇ

ਤੰਦਰੁਸਤੀ ਉਹਨਾਂ ਦੀ ਕਿ ਉਹਨਾਂ ਨੂੰ ਸਾਫ ਸੁਥਰਾ ਰੱਖੋ ਉਹਨਾਂ ਦੀ ਸਿਹਤ ਵੱਲ ਧਿਆਨ ਦਿਓ ਤੁਸੀਂ ਉਹਨਾਂ ਨੂੰ ਟਾਈਮ ਨਾਲ ਚਾਰਾ ਪਾਓ ਫੀਡ ਪਾਓ ਚੋਕਰ ਪਾਓ ਜੋ ਵੀ ਤੁਸੀਂ ਪਾਉਂਦੇ ਹੋ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਾਓ ਅਤੇ ਲਾਸਟ ਆਖਰੀ ਵਾਰ ਸਾਡੇ ਜਾਨਵਰ ਦੀ ਜਾਂਚ ਹੋਈ ਹੀ ਅਗਸਤ ਮਹੀਨੇ ਹਾਂਜੀ ਅਗਸਤ ਮਹੀਨੇ ਜਾਂਚ ਕਰਵਾਈ ਅਤੇ ਉਹਦੇ 'ਤੇ ਸਾਡਾ ਪੰਜ ਸੌ ਰੁਪਏ ਖਰਚਾ ਹੋਇਆ ਸੀ ਅਤੇ ਇਹ ਕੁਝ ਜ਼ਿਆਦਾ ਨਹੀਂ ਮਤਲਬ ਕਿ ਆਪਣੇ ਜਾਨਵਰਾਂ ਵਾਸਤੇ ਸਾਨੂੰ ਖਰਚਣੇ ਪੈਂਦੇ ਹੈ ਪੈਸੇ ਜਿੱਦਾਂ ਸਾਡੇ ਬੱਚੇ ਹੁੰਦੇ ਉਹਦੀ ਜਾਨਵਰ ਸੰਭਾਲਣੇ ਪੈਂਦੇ ਆ ਠੀਕ ਹੈ ਧੰਨਵਾਦ